ਭਾਰਤ ਦੀ ਆਵਾਜਾਈ ਪ੍ਰਣਾਲੀ ਤਾਂ ਬਹੁਤ ਚੰਗੀ ਹੈ ਇਸ ਵਿੱਚ ਗੱਡੀਆਂ ਬੱਸਾਂ ਹਵਾਈ ਜਹਾਜ਼ ਅਤੇ ਆਪਦੀਆਂ ਕਾਰਾਂ ਦਾ ਵੀ ਵਰਤੋਂ ਕੀਤੀ ਜਾਂਦੀ ਹੈ ਜ਼ਿਆਦਾ ਨੇੜੇ ਜਾਣ ਲਈ ਜ਼ਿਆਦਾਤਰ ਆਪਦਾ ਪਰਸਨਲ ਵਿਅਕਲ ਯੂਜ਼ ਕੀਤਾ ਜਾਂਦਾ ਹੈ ਅਤੇ ਦੂਰ ਦੀ ਯਾਤਰਾ ਦੇ ਲਈ ਟ੍ਰੇਨ ਅਤੇ ਬੱਸ ਦਾ ਸਫਰ ਕੀਤਾ ਜਾਂਦਾ ਹੈ ਜਿਹਨਾਂ ਕੋਲੋਂ ਥੋੜ੍ਹਾ ਗੁੰਜਾਇਸ਼ ਹੁੰਦੀ ਹੈ ਉਹ ਹਵਾਈ ਜਹਾਜ਼ ਰਾਹੀਂ ਵੀ ਯਾਤਰਾ ਕਰਦੇ ਹਨ ਬਾਕੀ ਯਾਤਰਾ ਦੇ ਵਿੱਚ ਚੁਣੌਤੀਆਂ ਬੜੀਆਂ ਆਉਂਦੀਆਂ ਹਨ ਜਿਵੇਂ ਟ੍ਰੇਨਾਂ ਆਮ ਤੌਰ 'ਤੇ ਲੇਟ ਹੋ ਜਾਂਦੀਆਂ ਹਨ ਅਤੇ ਹੋਰ ਵੀ ਸਾਫ ਸਫਾਈ ਦਾ ਪਸ ਪ੍ਰਬੰਧ ਨਹੀਂ ਹੁੰਦਾ ਇਸ ਕਰਕੇ ਲੋਕ ਆਪਣਾ ਪਰਸਨਲ ਵਹੀਕਲ ਹੀ ਯੂਜ਼ ਕਰਨਾ ਚਾਹੁੰਦੇ ਹਨ ਇਸ ਪ੍ਰਣਾਲੀ ਦੇ ਵਿੱਚ ਸੁਧਾਰ ਦੀ ਬਹੁਤ ਲੋੜ ਹੈ ਅਤੇ ਉਮੀਦ ਹੈ ਕਿ ਆਉਣ ਵਾਲੀਆਂ ਸਰਕਾਰਾਂ ਇਹਨਾਂ ਦੇ ਵਿੱਚ ਸੁਧਾਰ ਕਰਨਗੀਆਂ